ਮਸ਼ੀਨ ਵਿੱਚ ਸਾਨੂੰ ਸਭ ਤੋਂ ਚੁਣੌਤੀਪੂਰਨ ਕੰਮ ਸਿਲਾਈ ਕਢਾਈ ਦੇ ਵਿੱਚ ਮੈਨੂੰ ਲੱਗਦਾ ਹੈ ਲਾਈਨਿੰਗ ਵਾਲੇ ਸੂਟ ਸਿਊਣਾ ਲਾਈਨਿੰਗ ਲਗਾਉਣਾ ਸੂਟ 'ਤੇ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਪਰ ਜਦੋਂ ਵੀ ਇਹ ਬਣ ਕੇ ਤਿਆਰ ਹੁੰਦਾ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਦੂਜਾ ਕੰਮ ਮੈਨੂੰ ਮੁਸ਼ਕਿਲ ਲੱਗਦਾ ਹੈ ਜਿਹੜਾ ਆਪਾਂ ਸੂਟਾਂ ਦੇ ਗਲੇ ਤਿਆਰ ਕਰਦੇ ਹਾਂ ਅੱਜ ਕੱਲ ਰੈਡੀਮੇਡ ਗਲੇ ਵੀ ਮਿਲ ਜਾਂਦੇ ਹਨ ਪਰ ਜ਼ਿਆਦਾਤਰ ਲੋਕ ਹੱਥੀਂ ਬਣਾ ਗਲਾ ਪਸੰਦ ਕਰਦੇ ਹਨ ਉਹ ਸਭ ਤੋਂ ਪਹਿਲਾਂ ਗਲਾ ਬਣਾਉਣ ਲਈ ਸਾਨੂੰ ਟਿਕਣ ਉੱਤੇ ਆਪਣੇ ਨਾਪ ਅਕੋਡਿੰਗ ਗਲਾ ਬਣਾਉਣਾ ਪੈਂਦਾ ਹੈ ਜਿਸ 'ਤੇ ਜਿਵੇਂ ਦਾ ਵੀ ਡਿਜ਼ਾਇਨ ਅਸੀਂ ਚਾਹੁੰਦੇ ਹਾਂ ਉਹਦੇ ਤਾਂ ਡਿਜ਼ਾਇਨ ਡਰੋਅ ਕਰਕੇ ਅਸੀਂ ਆਪਣਾ ਮਨਪਸੰਦ ਗਲਾ ਤਿਆਰ ਕਰਕੇ ਅਤੇ ਸੂਟ ਉੱਤੇ ਲਗਾਉਂਦੇ ਹਾਂ ਇਹ ਥੋੜ੍ਹਾ ਮੁਸ਼ਕਿਲ ਅਤੇ ਲੰਬਾ ਕੰਮ ਹੁੰਦਾ ਹੈ ਪਰ ਇਸਨੂੰ ਜਦੋਂ ਇਹ ਬਣ ਜਾਂਦਾ ਤਾਂ ਬਹੁਤ ਸੋਹਣਾ ਲੱਗਦਾ ਹੈ ਕਈ ਵਾਰੀ ਅਸੀਂ ਮਸ਼ੀਨ 'ਤੇ ਕੰਮ ਕਰਦੇ ਹੋਈਏ ਤਾਂ ਉਸਨੂੰ ਸਾਡੀ ਸਿਲਾਈ ਮਸ਼ੀਨ ਕੀ ਟਾਪ ਕਰਦੀ ਹੈ ਜੋ ਕਿ ਬਹੁਤ ਹੀ ਤੰਗ ਕਰਨ ਵਾਲਾ ਕੰਮ ਹੁੰਦਾ ਹੈ ਸਾਨੂੰ ਸੋ ਸਾਨੂੰ ਬਾਰ ਬਾਰ ਆਪਣੀ ਮਸ਼ੀਨ ਨੂੰ ਅ ਮਸ਼ੀਨ ਨੂੰ ਥੱਲਿਓ ਖੋਲ੍ਹ ਕੇ ਸਹੀ ਕਰਨਾ ਪੈਂਦਾ ਹੈ ਕਈ ਵਾਰੀ ਸਾਡੀ ਸੂਈ ਆਪਣੇ ਕੱਪੜੇ ਉੱਤੇ ਨਹੀਂ ਸਹੀ ਬੈਠਦੀ ਤਾਂ ਟੁੱਟ ਜਾਂਦੀ ਹੈ ਇਹ ਵੀ ਜਦੋਂ ਰੁਕਾਵਟ ਆਉਂਦੀ ਆ ਸਾਡੇ ਕੰਮ ਦੇ ਵਿੱਚ ਤਾਂ ਆਪਾਂ ਥੋੜ੍ਹੇ ਤੰਗ ਹੋ ਜਾਂਦੇ ਹਾਂ ਪਰ ਸਾਨੂੰ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ ਹਾਲ ਹੀ 'ਚ ਮੈਂ ਇੱਕ ਅੰਬਰੇਲਾ ਫਰੋਕ ਸੂਟ ਸੀਤਾ ਸੀ ਜਿਹਨੂੰ ਬਣਨ 'ਚ ਕਾਫੀ ਟਾਈਮ ਲੱਗਾ ਸੀ ਪਰ ਇਹ ਬਣ ਕੇ ਗਿਆ ਬਹੁਤ ਸੋਹਣਾ ਲੱਗਾ ਸੀ ਇਸ ਮੇਰਾ ਕੱਪੜਾ ਥੋੜ੍ਹਾ ਮਸ਼ੀਨੀ ਵਰਕ ਥੋੜ੍ਹਾ ਸ਼ੀਸ਼ੇ ਵਾਲੇ ਵਰਕ ਵਾਲਾ ਸੀਗਾ ਜਿਸਦੇ ਉੱਤੇ ਸੂਈ ਬਾਰ ਬਾਰ ਟੁੱਟੀ ਜਾਣ ਦਈ ਸੀ ਬਟ ਮੈਂ ਸਬਰ ਨਾਲ ਕੰਮ ਲਿਤਾ ਅਤੇ ਏ ਅਤੇ ਸਬਰ ਨਾਲ ਕੰਮ ਲੈ ਕੇ ਉਹਨੂੰ ਸੀਤਾ ਅਤੇ ਜਦੋਂ ਸੀਕੇ ਤਿਆਰ ਹੋਇਆ ਤਾਂ ਬਹੁਤ ਹੀ ਸੋਹਣਾ ਲੱਗਿਆ ਧੰਨਵਾਦ